ਮੈਨੂੰ ਹਰ ਤਰ੍ਹਾਂ ਦਾ ਮੌਸਮ ਪਸੰਦ ਹੈ ਲੇਕਿਨ ਹਰ ਇੱਕ ਮੌਸਮ ਦਾ ਇੱਕ ਇੱਕ ਆਪਣਾ ਆਪਣਾ ਮਜ਼ਾ ਹੁੰਦਾ ਫੋਰ ਇਗਜਾਮਪਲ ਜਿੱਦਾਂ ਮੈਨੂੰ ਸਰਦੀਆਂ ਦੇ ਵਿੱਚ ਸੁਬਾਹ ਉੱਠ ਕੇ ਕੋਫੀ ਪੀਣਾ ਫਿਰ ਧੁੱਪ ਦੇ ਵਿੱਚ ਜਾ ਕੇ ਬੈਠਣਾ ਸਨੈਕਸ ਖਾਣਾ ਕੁਝ ਨਾ ਕੁਝ ਜਿਵੇਂ ਸਰਦੀਆਂ ਦੇ ਵਿੱਚ ਪਿੰਨੀਆਂ ਬਣਦੀਆਂ ਨੇ ਯਾ ਫਿਰ ਬਿਸਕਿਟ ਯਾ ਗਜਰੇਲਾ ਬਣਵਾਇਆ ਜਾਂਦਾ ਹੈ ਇਹ ਸਭ ਖਾਣਾ ਸਨੈਕਸ ਦੇ ਵਾਜੋ ਬਹੁਤ ਪਸੰਦ ਹੈ ਅਤੇ ਨਾਲ਼ ਬਾਅਦ ਵਿੱਚ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਇਹੋ ਜਿਹੀਆਂ ਚੀਜ਼ਾਂ ਖਾਣਾ ਵੀ ਬਹੁਤ ਪਸੰਦ ਹੈ ਅਤੇ ਗਰਮੀਆਂ ਦੇ ਵਿੱਚ ਵੀ ਅਗਰ ਗਰਮੀਆਂ ਦੀ ਗੱਲ ਕਰੀਏ ਤਾਂ ਏ ਜਿਹੜਾ ਗਰਮੀਆਂ ਦੇ ਵਿੱਚ ਅੰਬ ਦਾ ਨਾਮ ਸੁਣ ਕੇ ਹੀ ਜਿਹੜਾ ਚਾਅ ਚੜ੍ਹ ਜਾਂਦਾ ਹੈ ਅੰਬ ਤੋਂ ਬਣੇ ਹੋਏ ਬਹੁਤ ਸਾਰੇ ਪਦਾਰਥ ਆਮ ਪਾਪੜ ਯਾ ਮੈਂਗੋ ਸ਼ੇਕ ਇਸ ਸਭ ਪੀਣਾ ਵੀ ਮੈਨੂੰ ਬਹੁਤ ਵਧੀਆ ਲੱਗਦਾ